ਜਾਨਵਰਾਂ ਦੀ ਦੇਖਭਾਲ ਕਰਨ ਲਈ ਕੁਦਰਤ ਕੁਦਰਤੀ ਅਤੇ ਜੈਵਿਕ ਢੰਗਾਂ ਦੀ ਵਰਤੋਂ ਕਰਨ ਲਈ ਬਹੁਤ ਸਾਰੇ ਹੀ ਲਾਭ ਹਨ ਜਿਹਨਾਂ ਨਾਲ ਜਾਨਵਰਾਂ ਦੀ ਬਹੁਤ ਹੀ ਚੰਗੀ ਤਰ੍ਹਾਂ ਦੇਖਭਾਲ ਅਤੇ ਉਹਨਾਂ ਦੀ ਮਦਦ ਹੋ ਜਾਂਦੀ ਹੈ ਉਹਨਾਂ ਨੂੰ ਇਹ ਜੈਵਿਕ ਅਤੇ ਕੁਦਰਤੀ ਢੰਗਾਂ ਦੀ ਢੰਗਾਂ ਨਾਲ ਉਹਨਾਂ ਦੀ ਮਦਦ ਕਰਨ ਨਾਲ ਉਹਨਾਂ ਨੂੰ ਕੋਈ ਹਾਨੀ ਵੀ ਨਹੀਂ ਹੁੰਦੀ ਜਿਵੇਂ ਕਿ ਕਈ ਸਾਰੇ ਐਸੇ ਵੀ ਲੋਕ ਹਨ ਜੋ ਉਹਨਾਂ ਨੂੰ ਲ ਜੰਗਲਾਂ ਵਿੱਚ ਜਾ ਕੇ ਜਾਨਵਰਾਂ ਦੀ ਮਦਦ ਕਰੇ ਨਾ ਦਾ ਜਿੰਮਾ ਦਿੱਤਾ ਗਿਆ ਹੈ ਸਰਕਾਰ ਨੇ ਵੀ ਜਾਨਵਰਾਂ ਦੀ ਦੇਖਭਾਲ ਲਈ ਕਈ ਸਾਰੀਆਂ ਟੀਮਸ ਬਣਾਈਆਂ ਹੋਈਆਂ ਹਨ ਜੋ ਕਿ ਅਲੱਗ ਅਲੱਗ ਜੰਗਲਾਂ ਵਿੱਚ ਜਾ ਕੇ ਜਾਨਵਰਾਂ ਨੂੰ ਬਹੁਤ ਸਾਰੀਆਂ ਕੁਦਰਤੀ ਅਤੇ ਜੈਵਿਕ ਢੰਗਾਂ ਦੀ ਵਰਤੋਂ ਕਰਨ ਵਰਤੋਂ ਨਾਲ ਉਹਨਾਂ ਦੀ ਦੇਖਭਾਲ ਕਰਦੇ ਹਨ ਜੋ ਕਿ ਬਹੁਤ ਹੀ ਇੱਕ ਚੰਗੀ ਗੱਲ ਹੈ ਸਾਨੂੰ ਵੀ ਜਾਨਵਰਾਂ ਦੀ ਕੁਦਰਤੀ ਅਤੇ ਜੈਵਿਕ ਢੰਗਾਂ ਨਾਲ ਹੀ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਕਈ ਪਸ਼ੂ ਪਕਸ਼ੀ ਬਹੁਤ ਸਾਰੇ ਪਸ਼ੂ ਪਕਸ਼ੀ ਜੋ ਕਿ ਬਹੁਤ ਹੀ ਮਾੜੇ ਢੰਗ ਵਿੱਚ ਹੁੰਦੇ ਹਨ ਉਹਨਾਂ ਦੀ ਮਦਦ ਸਾਨੂੰ ਕਰਨੀ ਚਾਹੀਦੀ ਹੈ ਗਾਈਆਂ ਮੱਝਾ ਬੈਂਸਾ ਆਦਿ ਨੂੰ ਵੀ ਕੁਦਰਤੀ ਅਤੇ ਜੈਵਿਕ ਢੰਗ ਦਾ ਵੀ ਭੋਜਨ ਖਵਾਉਣਾ ਚਾਹੀਦਾ ਹੈ ਜਿਸ ਨਾਲ ਕਿ ਉਹਨਾਂ ਦੀ ਸਿਹਤ ਬਣੀ ਰਹੇ ਅਤੇ ਉਹ ਪੌਸ਼ਟਿਕ ਅਤੇ ਸਿਹਤਮੰਦ ਦੁੱਧ ਦਿੰਦੇ ਰਹਿਣ ਇਹ ਉਹਨਾਂ ਦੀ ਜੈਵਿਕ ਅਤੇ ਕੁਦਰਤੀ ਢੰਗ ਨਾਲ ਕੀਤੀ ਸਿਹਤ ਨਾਲ ਦੇਖਭਾਲ ਦਾ ਹੀ ਸਭ ਤੋਂ ਵੱਡਾ ਨਤੀਜਾ ਹੁੰਦਾ ਹੈ